ਦੋਸਤੋ ਜਦੋਂ ਮੈਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਮੈਂ ਅਕਸਰ ਆਪਣੇ ਇੱਕ ਦੋਸਤ ਹਰਜਿੰਦਰ ਸਿੰਘ ਨਾਲ਼ ਸਲਾਹ ਕਰਦਾ ਹੁੰਦਾ ਪਿਛਲੇ ਹਫ਼ਤੇ ਇੱਦਾਂ ਹੀ ਮੈਂ ਇੱਕ ਜਾਮ ਦੇ ਵਿੱਚ ਫ਼ਸ ਗਿਆ ਤਾਂ ਮੈਂ ਆਪਣੇ ਮਿੱਤਰ ਨਾਲ਼ ਗੱਲ ਕੀਤੀ ਉਹਨੇ ਮੈਨੂੰ ਦੱਸਿਆ ਕਿ ਤੂੰ ਇਸ ਰਸਤੇ ਰਾਹੀਂ ਅੱਗੇ ਚਲਾ ਜਾ ਅਤੇ ਉਸ ਰਸਤੇ ਦੇ ਅੱਗੇ ਜਾ ਕੇ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਏਗੀ ਸੋ ਮੈਂ ਉਹਦੀ ਸਲਾਹ ਦੇ ਅਨੁਸਾਰ ਜੋ ਉਹਨੇ ਮੈਨੂੰ ਰਸਤਾ ਦੱਸਿਆ ਮੈਂ ਉਹਦੇ ਅਕੋਡਿੰਗ ਅੱਗੇ ਰਸਤਾ ਚਲਾ ਗਿਆ ਅਤੇ ਕੁਛ ਮਿੰਟਾਂ ਦੇ ਵਿੱਚ ਮੈਂ ਜਾਮ ਤੋਂ ਦੂਰ ਹੋ ਗਿਆ